ਸਾਡੇ ਰਾਜ ਵਿੱਚ ਬਹੁਤ ਹੀ ਪ੍ਰਮੁੱਖ ਧਾਰਮਿਕ ਆਗੂ ਅਤੇ ਸ਼ਖਸੀਅਤਾਂ ਹਨ ਜਿਨ੍ਹਾਂ ਦਾ ਬਹੁਤ ਹੀ ਆਦਰ ਅਤੇ ਮਾਣ ਨਾਲ਼ ਸਤਿਕਾਰ ਕੀਤਾ ਜਾਂਦਾ ਹੈ ਸਿੱਖ ਧਰਮ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਜਿਵੇਂ ਕਥਾਵਾਚਕ ਇਸ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਜੀ ਹਾਂਜੀ ਇਸ ਤੋਂ ਇਲਾਵਾ ਸੰਤ ਬਾਬਾ ਮਹਾਂਪੁਰਖ ਦਇਆ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ ਈਸ਼ਵਰ ਸਿੰਘ ਵਾਲੇ ਇਹਨਾਂ ਦਾ ਬਹੁਤ ਹੀ ਆਦਰ ਅਤੇ ਮਾਣ ਨਾਲ਼ ਸੰਗਤਾਂ ਸਤਿਕਾਰ ਕਰਦੀਆਂ ਹਨ ਇਹ ਸਾਡੇ ਬਹੁਤ ਹੀ ਵਧੀਆ ਧਾਰਮਿਕ ਆਗੂ ਹਨ ਜੋ ਸਾਨੂੰ ਧਰਮ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ ਇਹਨਾਂ ਤੋਂ ਸਾਨੂੰ ਬਹੁਤ ਹੀ ਵਧੀਆ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਗੁਰਬਾਣੀ ਨਾਲ਼ ਜੁੜਨਾ ਚਾਹੀਦਾ ਹੈ ਸਾਨੂੰ ਮਹਾਰਾਜ ਨੇ ਧਰਤੀ 'ਤੇ ਗੁਰਬਾਣੀ ਪੜ੍ਹਨ ਲਈ ਹੀ ਭੇਜਿਆ ਹੈ ਮਨੁੱਖ ਆਪਣੇ ਕੰਮਾਂ ਦੇ ਰੁਝੇਵਿਆਂ ਕਾਰਨ ਗੁਰਬਾਣੀ ਨੂੰ ਭੁੱਲ ਗਿਆ ਹੈ ਆਪਣੇ ਬੱਚਿਆਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਹੱਕ ਖਾਣ ਨਾਲ਼ ਬਹੁਤ ਹੀ ਮਾੜਾ ਹੁੰਦਾ ਹੈ ਸਾਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਧਾਰਮਿਕ ਪ੍ਰਤੀ